ਮੈਨੂੰ ਮੇਰੇ ਸ਼ਹਿਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਮਨਪਸੰਦ ਹਨ ਜਿੱਦਾਂ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਵੇਖਣ ਵਾਲੀਆਂ ਵੀ ਹਨ ਖਾਣ ਵਾਲੀਆਂ ਵੀ ਹਨ ਚੀਜ਼ਾਂ ਜਿੱਦਾਂ ਕਿ ਇਹ ਸ਼ਹਿਰ ਵਿੱਚ ਸਟਰੀਟ ਫੂਡ ਬਹੁਤ ਜ਼ਿਆਦਾ ਹੈ ਅਸੀਂ ਕਦੇ ਵੀ ਜਾਈਏ ਕੁਛ ਨਾ ਕੁਛ ਖਾਣ ਨੂੰ ਮਿਲ ਹੀ ਜਾਂਦਾ ਹੈ ਇਹ ਸ਼ਹਿਰ ਵਿੱਚ ਬਹੁਤ ਸਾਰੇ ਮਲਟੀਨੈਸ਼ਨਲ ਕੰਪਨੀਜ ਨੇ ਆਪਣੇ ਰੈਸਟੋਰੈਂਟਸ ਵੀ ਖੋਲ੍ਹੇ ਹੋਏ ਹਨ ਅੱਜ ਕੱਲ੍ਹ ਤਾਂ ਲੋਕਾਂ ਨੂੰ ਕੌਫੀ ਪੀਣ ਦਾ ਵੀ ਬਹੁਤ ਕਰੇਜ਼ ਹੈ ਕਿਉਂਕਿ ਇੱਥੇ ਬਹੁਤ ਸਾਰੀਆਂ ਫੇਮਸ ਕੌਫੀ ਬ੍ਰਾਂਡਸ ਨੇ ਵੀ ਆਪਣੀਆਂ ਸ਼ੋਪਸ ਓਪਨ ਕੀਤੀਆਂ ਹਨ ਜਿੱਦਾਂ ਕਿ ਸਾਨੂੰ ਪਤਾ ਹੈ ਅੰਮ੍ਰਿਤਸਰ ਵਿਚ ਗੋਲਡਨ ਟੈਂਪਲ ਵੀ ਹੈ ਅਤੇ ਉਹਦੇ ਆਲੇ ਦੁਆਲੇ ਬਹੁਤ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਹਨ ਜਿੱਦਾਂ ਕਿ ਕੁਲਫੀਆਂ ਲੱਡੂ ਮੈਕਡੋਨਲਸ ਵੀ ਹੈ ਡੋਮੀਨੋਜ ਵੀ ਹੈ ਅਤੇ ਹੋਰ ਵੀ ਬਹੁਤ ਸਾਰੇ ਨਵੇਂ ਨਵੇਂ ਰੈਸਟੋਰੈਂਟਸ ਹਨ ਲੋਕ ਇੱਥੇ ਬ੍ਰਦਰ ਢਾਬੇ ਜਾਣਾ ਵੀ ਬਹੁਤ ਪਸੰਦ ਕਰਦੇ ਹਨ ਕਿਉਂਕਿ ਉੱਥੋਂ ਦਾ ਖਾਣਾ ਇੱਕ ਤਾਂ ਸ਼ੁੱਧ ਸ਼ਾਕਾਹਾਰੀ ਹੁੰਦਾ ਹੈ ਦੂਜਾ ਇਸ ਕਰਕੇ ਜਾਂਦੇ ਹਨ ਕਿਉਂਕਿ ਉਹ ਬਹੁਤ ਵਧੀਆ ਅਤੇ ਰੀਜ਼ਨੇਬਲ ਪ੍ਰਾਈਸ 'ਤੇ ਹੁੰਦਾ ਹੈ ਗੋਲਡਨ ਟੈਂਪਲ ਦੇ ਆਲੇ ਦੁਆਲੇ ਹੀ ਬਹੁਤ ਸਾਰੀਆਂ ਚੀਜ਼ਾਂ ਹਨ ਜਿਹੜਾ ਕਿ ਬੰਦਾ ਟੂਰਿਸਟ ਆਉਂਦੇ ਹਨ ਅਤੇ ਉੱਥੋਂ ਖਾ ਪੀ ਕੇ ਜਾਂਦੇ ਹਨ ਇੱਥੇ ਬਹੁਤ ਸਾਰੀਆਂ ਐਜੂਕੇਸ਼ਨਲ ਇੰਸੀਟਿਊਟਸ ਵੀ ਹਨ ਜਿੱਦਾਂ ਖਾਲਸਾ ਕੋਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਗੈਰਾ ਅਤੇ ਉਹਨਾਂ ਦੇ ਲਾਗੇ ਲਾਗੇ ਬਹੁਤ ਸਾਰੀਆਂ ਮਾਰਕਿਟਸ ਵੀ ਹਨ ਜਿੱਦਾਂ ਯੂ ਟੀ ਮਾਰਕੀਟ ਕਹਿ ਸਕਦੇ ਹਾਂ ਅਤੇ ਉੱਥੇ ਵੀ ਬਹੁਤ ਸਾਰੀਆਂ ਖਾਣ ਪੀਣ ਵਾਲੀਆਂ ਰੇਹੜੀਆਂ ਲੱਗਦੀਆਂ ਹਨ ਅਤੇ ਅੱਜ ਕੱਲ੍ਹ ਤਾਂ ਇੱਥੇ ਇੰਟਰਨੈਸ਼ਨਲ ਫੂਡ ਵੀ ਮਿਲਣਾ ਸ਼ੁਰੂ ਹੋ ਗਿਆ ਹੈ ਜਿੱਦਾਂ ਕਿ ਅਸੀਂ ਵੇਖਦੇ ਹਾਂ ਲੋਕ ਕੋਲਡ ਕੌਫੀ ਹੌਟ ਕੌਫੀ ਵਗੈਰਾ ਪੀਂਦੇ ਹਨ ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਖਾਂਦੇ ਪੀਂਦੇ ਹਨ ਜੋ ਕਿ ਇੰਡੀਆ ਦੀਆਂ ਨਹੀਂ ਹੁੰਦੀਆਂ ਪਰ ਇੰਟਰਨੈਸ਼ਨਲੀ ਬਹੁਤ ਫੇਮਸ ਹੁੰਦੀਆਂ ਹਨ ਜਿੱਦਾਂ ਕਿ ਆਪਾਂ ਵੇਖ ਸਕਦੇ ਹਾਂ ਕਿ ਚਾਈਨੀਜ਼ ਵਗੈਰਾ ਦਾ ਵੀ ਬਹੁਤ ਕ੍ਰੇਜ਼ ਹੈ ਅਤੇ ਲੋਕ ਬਹੁਤ ਖਾਣਾ ਪੀਣਾ ਬਹੁਤ ਪਸੰਦ ਕਰਦੇ ਹਨ ਇੱਥੇ ਬਹੁਤ ਸਾਰੇ ਮੇਲੇ ਵੀ ਲੱਗਦੇ ਹਨ ਜਿਹਦੇ ਵਿੱਚ ਬਹੁਤ ਸਾਰੀਆਂ ਖਾਣ ਪੀਣ ਵਾਲੀਆਂ ਵੱਖਰੀਆਂ ਵੱਖਰੀਆਂ ਵਰਾਇਟੀਆਂ ਵੀ ਹੁੰਦੀਆਂ ਹਨ ਥੈਂਕ ਯੂ